ਸਾਇੰਸਦਾਨਾਂ ਨੇ ਦੁਨੀਆਂ ਨੂੰ ਵੱਖਰੀਆਂ ਵੱਖਰੀਆਂ ਕਾਢਾਂ ਕੱਢਕੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਬਦਲ ਦਿੱਤਾ ਹੈ ਸਾਡੀ ਜ਼ਿੰਦਗੀ ਨੂੰ ਤੈਕਨੋਲਜੀ ਨੇ ਇੰਨਾ ਕੁ ਬਦਲ ਦਿੱਤਾ ਹੈ ਕਿ ਅਸੀਂ ਹੁਣ ਮੋਬਾਇਲ ਤੋਂ ਵਗੈਰ ਰਹਿ ਨਹੀਂ ਸਕਦੇ ਇਨਸਾਨ ਚੰਦਰਮਾ 'ਤੇ ਪਹੁੰਚ ਗਿਆ ਹੈ ਇਸ ਹੀ ਤਰ੍ਹਾਂ ਤੈਕਨੋਲਜੀ ਦੀ ਇੱਕ ਦੇਣ ਸਮਾਟਫ਼ੋਨ ਹੈ ਜਿਸ ਵਿੱਚ ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਸੋਖਾ ਬਣਾ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਅਸੀਂ ਕਿਤੇ ਜਾਣਾ ਹੋਵੇ ਤਾਂ ਸਭ ਤੋਂ ਪਹਿਲਾਂ ਟਿਕਟਾਂ ਦੀ ਬੁਕਿੰਗ ਮੋਬਾਇਲ ਤੋਂ ਹੀ ਕਰਵਾ ਲੈਂਦੇ ਹਾਂ ਜਦੋਂ ਅਸੀਂ ਕਿਤੇ ਹੋਟਲ ਵਿੱਚ ਰਹਿਣਾ ਹੋਵੇ ਤਾਂ ਉੱਥੇ ਰਹਿਣ ਵਾਸਤੇ ਵੀ ਅਸੀਂ ਮੋਬਾਇਲ ਦੀ ਵਰਤੋਂ ਕਰਦੇ ਹਾਂ ਜਾਂ ਕੋਈ ਬਿੱਲ ਵਗੈਰਾ ਪੇ ਪੇ ਕਰਨਾ ਹੋਵੇ ਤਾਂ ਉਸਦਾ ਬਿੱਲ ਦਾ ਭੁਗਤਾਨ ਕਰਨ ਵਾਸਤੇ ਵੀ ਅਸੀਂ ਮੋਬਾਈਲ ਦੀ ਵਰਤੋਂ ਕਰਦੇ ਹਾਂ ਹੋਰ ਅਸੀਂ ਆਪਣੇ ਫ਼ੋਨ ਰਾਹੀਂ ਬੈਂਕ ਦੇ ਵਿੱਚ ਪੈਸਿਆਂ ਦਾ ਲੈਣ ਦੇਣ ਕਰਨਾ ਹੋਵੇ ਜਾਂ ਕਿਸੀ ਯਾਰ ਦੋਸਤ ਨੂੰ ਪੈਸੇ ਭੇਜਣੇ ਹੋਣ ਤਦ ਵੀ ਅਸੀਂ ਫ਼ੋਨ ਦੀ ਵਰਤੋ ਕਰਦੇ ਹਾਂ ਅੱਜ ਕੱਲ੍ਹ ਤਾਂ ਖਰੀਦਦਾਰੀ ਵੀ ਫ਼ੋਨ ਰਾਹੀਂ ਹੀ ਹੋ ਜਾਂਦੀ ਹੈ ਨਾਲ ਪੈਸਿਆਂ ਦੀ ਖਰੀਦਦਾਰੀ ਦੇ ਨਾਲ ਨਾਲ ਪੈਸਿਆਂ ਦੀ ਦਾ ਭੁਗਤਾਨ ਵੀ ਉੱਥੇ ਹੀ ਹੋ ਜਾਂਦਾ ਹੈ